ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਂ ਸਿੱਖ ਧਰਮ ਤੋਂ ਬੀਲੋਂਗ ਕਰਦਾ ਹਾਂ ਇਸ ਵਿੱਚ ਕੀ ਹੈ ਕਿ ਅਸੀਂ ਬਹੁਤ ਹੀ ਅਲੱਗ ਅਲੱਗ ਤਿਉਹਾਰ ਮਨਾਉਂਦੇ ਹਾਂ ਜਿਵੇਂ ਕਿ ਗੱਲ ਕਰ ਲਈਏ ਗੁਰਪੁਰਬ ਦੀ ਸ਼ਹੀਦੀ ਪੁਰਬ ਦੀ ਅਤੇ ਬਾਕੀ ਦੀਵਾਲੀ ਦੀ ਅਤੇ ਵਿਸਾਖੀ ਦੀ ਕਿ ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਘਰੋਂ ਨਹਾ ਨਹਾ ਕੇ ਇਸ਼ਨਾਨ ਕਰਕੇ ਆਪਣੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਜਾ ਕੇ ਕੇ ਬਾਣੀ ਦਾ ਕੀਰਤਨ ਦਾ ਆਪਣਾ ਅਨੰਦ ਮਾਣਦੇ ਹਾਂ ਉਸ ਤੋਂ ਬਾਅਦ ਲੰਗਰ ਹਾਲ ਵਿੱਚ ਜਾ ਕੇ ਸੇਵਾ ਕਰਦੇ ਹਾਂ ਜਿੱਥੇ ਕਿ ਬਹੁਤ ਹੀ ਸੰਗਤ ਇਕੱਠੀ ਹੋਈ ਹੁੰਦੀ ਹੈ ਅਤੇ ਸਾਡੇ ਧਰਮ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਇੱਕ ਆਪਾਂ ਗੱਲ ਕਰ ਲਈਏ ਸਜਾਵਟ ਦੀ ਤਾਂ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੇ ਸੁੰਦਰ ਫੁੱਲਾਂ ਦੀ ਮਦਦ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਜਾਂਦਾ ਹੈ ਨਗਰ ਕੀਰਤਨ ਨਿਕਲਦੇ ਨੇ ਜਿਸ ਵਿੱਚ ਆਪਣਾ ਅੱਜ ਕੱਲ੍ਹ ਦੇ ਨੌਜਵਾਨ ਬੱਚੇ ਸਾਰੇ ਗੱਤਕਾ ਖੇਲਦੇ ਨੇ ਕਿ ਜੋ ਕਿ ਸਾਨੂੰ ਦਰਸਾਉਂਦਾ ਹੈ ਕਿ ਸਾਨੂੰ ਇੱਕ ਰਲ ਮਿਲ ਕੇ ਹਰ ਇੱਕ ਧਰਮ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ